ਹੈਲੋ ਹਾਂਜੀ ਰਾਮ ਸਿੰਘ ਜੀ ਆ ਗਏ ਹਾਂਜੀ ਹਾਂਜੀ ਬਹੁਤ ਵਧੀਆ ਕਿੱਥੋਂ ਵਧੀਆ ਜੀ ਵਧੀਆ ਠੀਕ ਆ ਚੱਲੀ ਜਾਂਦੀ ਆ ਬਸ ਬੱਸ ਆ ਜਿਹੜੀ ਆ ਚੱਲਦੀ ਆ ਜੀ ਇਹ ਹਵਾ ਹੁਵਾ ਪੂਰੇ ਦੀ ਚੱਲਦੀ ਆ ਇਹਨੇ ਤਾਂ ਫਸਲਾਂ ਲੱਗਦਾ ਝਾੜ ਏ ਦੇਣੀਆਂ ਨੇਗੀਆਂ ਬਸ ਰੱਬ ਦੇ ਰੰਗ ਨੇ ਜੀ ਦੇਖੋ ਦੇਖੋ ਕਿੰਨਾ ਕਿੰਨਾ ਆਪਾਂ ਕਰਜ਼ਾ ਲੈ ਕੇ ਕਿੰਨੇ ਕਿੰਨੇ ਵਧੀਆ ਬੀਜ ਪਾਏ ਹੋਏ ਨੇਗੇ ਕਿੰਨਾ ਵਧੀਆ ਆਪਾਂ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਵਧੀਆ ਤੋਂ ਵਧੀਆ ਲਿਆ ਕੇ ਖਾਦਾਂ ਪਾਈਆਂ ਨੇ ਜੀ ਦੇਖੋ ਆਪਾਂ ਤਾਂ ਕਹਿੰਦੇ ਹਾਂ ਵੀ ਜੇ ਰੱਬ ਦਾ ਹਾਂਜੀ ਦੇਖੋ ਆਪਾਂ ਤਾਂ ਜੀ ਆਪ ਏ ਖਾਂਦੇ ਸੀ ਨਾਲ ਨਾਲ ਪਤਾ ਬਾਹਰਲੇ ਦੇਸ਼ਾਂ 'ਚ ਵੀ ਅੰਨ ਆਪਣਾ ਭੇਜਣ ਲੱਗ ਗਏ ਸੀਗੇ ਦੇਖੋ ਕਣਕ ਚਾਵਲ ਬਸ ਬਸ ਉਹ ਸਰਕਾਰ ਦੇ ਕਰਕੇ ਹੀ ਆਪਾਂ ਨੂੰ ਹੋ ਗਿਆ ਸੀ ਜੀ ਇਹ ਵਧੀਆ ਦੇਖੋ ਵਧੀਆ ਤੋਂ ਵਧੀਆ ਆਪਾਂ ਬੀਜ ਲਿਆਉਂਦੇ ਹਾਂਜੀ ਹਾਂਜੀ ਹਾਂ ਮੈਂ ਵੀ ਆਪਣੇ ਮੁੰਡੇ ਨੂੰ ਨਾਲ ਲੈ ਕੇ ਜਾਂਦਾ ਰਿਹਾ ਜੀ ਵੀ ਇਹ ਵੀ ਕਣਕ ਹਾਂਜੀ ਬਹੁਤ ਵਧੀਆ ਅਸੀਂ ਸਾਰੇ ਹੀ ਲੋਕ ਉਥੋਂ ਲੈ ਕੇ ਆਉਂਦੇ ਸੀ ਇਹਦੇ ਨਾਲ ਇਹ ਆਪਣੇ ਖੇਤਾਂ ਨੂੰ ਭਾਗ ਲੱਗੇ ਜੀ ਉਦੋਂ ਹਾਂ ਟਰੈਕਟਰ ਉਦੋਂ ਹੀ ਖਰੀਦਿਆ ਸੀ ਹਰੀ ਕ੍ਰਾਂਤੀ ਵੇਲੇ ਹੀ ਮੈਂ ਟਰੈਕਟਰ ਲਿਤਾ ਸੀ ਜੀ ਉਹਦੇ ਨਾਲ ਦੇਖੋ ਸਾਰਾ ਪਿੰਡ ਦੇਖੋ ਆਏ ਨੱਚਦਾ ਫਿਰਦਾ ਸੀ ਇੱਕ ਤਾਂ ਹੈ ਵੀ ਨੱਚਦਾ ਫਿਰਦਾ ਸੀ ਜੀ ਦੇਖੋ ਲਹਿਰਾਉਂਦੀਆਂ ਫਸਲਾਂ ਨੂੰ ਦੇਖ ਦੇਖ ਕੇ ਸਾਰੇ ਪਾਸੇ ਹਰਿਆਲੀ ਓ ਹਰਿਆਲੀ ਅਸੀਂ ਤਾਂ ਇਹਨੂੰ ਅੰਨਦਾਤਾ ਕਹਿਣ ਲੱਗੇ ਗਏ ਸੀ ਜੀ ਹਰੀ ਕ੍ਰਾਂਤੀ ਕਰਕੇ ਕਹਿੰਦੇ ਸੀਗੇ ਵੀ ਆਪ ਵੀ ਇਹ ਖਾਂਦਾ ਅਤੇ ਦੂਜੇ ਦੇਸ਼ਾਂ ਨੂੰ ਵੀ ਇਹ ਰਜਾਉਂਦਾ ਭੰਡਾਰੇ ਭਰ ਗਏ ਸੀ ਇਹਦੇ ਨਾਲ ਤਾਂ ਆਪਣੇ

ਆਹ ਜਿੰਨਾ ਆਪਾਂ ਨੇ ਕਰਜ਼ਾ ਕੁਰਜਾ ਲਿੱਤਾ ਹੋਇਆ ਸੀ ਸਭ ਆਪਾਂ ਨਾਲ ਈ ਮੋੜਤਾ ਸੀ ਜੀ ਫਸਲ ਏ ਇੰਨੀ ਹੁੰਦੀ ਸੀਗੀ ਹੁਣ ਵੀ ਜਿਹੜੀਆਂ ਫਸਲਾਂ ਹੋ ਰਹੀਆਂ ਨੇ ਬਸ ਉਹੀ ਸਰਕਾਰ ਦੇ ਕਰਕੇ ਹੀ ਹੋ ਰਹੀਆਂ ਨੇ ਆਪਣੀਆਂ ਉਹੀ ਹਰੀ ਕ੍ਰਾਂਤੀ ਦੇ ਬੀਜ ਆਏ ਹੋਏ ਨੇ ਹਰੀ ਕ੍ਰਾਂਤੀ ਦੀਆਂ ਹੀ ਆਪਣੇ ਕੋਲ ਦੇਖੋ ਵਧੀਆ ਤੋਂ ਵਧੀਆ ਖਾਦ ਆ ਰਹੀ ਆ ਹਾਂ ਲਓ ਮੈਂ ਤਾਂ ਕੋਠੀ ਵੀ ਪਾ ਲਈ ਜੀ ਦੇਖੋ ਚਾਰ ਪੈਸੇ ਜੋੜ ਕੇ ਹਾਂ ਬਸ ਹੁਣ ਆ ਦੇਖਦੀ ਹਾਂ ਜੀ ਆਹ ਮੁੰਡਾ ਇਹਦੀ ਮਾਂ ਕਹੀ ਜਾਂਦੀ ਆ ਵੀ ਮੁੰਡੇ ਨੂੰ ਬਾਹਰ ਭੇਜ ਦਿਓ ਫਿਰ ਮੈਂ ਪਰ ਇਹਨੂੰ ਕਿਹਾ ਵੀ ਆਪਾਂ ਬਾਹਰ ਨਹੀਂ ਭੇਜਦੇ ਵੀ ਆਪਣੇ ਕੋਲ ਵਧੀਆ ਜ਼ਮੀਨ ਹੈਗੀ ਆ ਮੁੰਡੇ ਨੂੰ ਵੀ ਆਪਾਂ ਵਧੀਆ ਉਹਨੇ ਐਗਰੀਕਲਚਰ ਤੋਂ ਹਾਂ ਐਗਰੀਕਲਚਰ ਤੋਂ ਕਰਿਆ ਏ ਜੀ ਕੋਰਸ ਦੱਸਿਆ ਉਹਨਾਂ ਨੇ ਸਾਰਾ ਇਹਨੂੰ ਖੇਤੀ ਬਾਰੇ ਅਤੇ ਕਹਿੰਦਾ ਮੈਂ ਤਾਂ ਹੁਣੇ ਖੇਤੀ ਓ ਕਰੂੰਗਾ ਕੰਬਾਈਨ ਹਾਂ ਕੰਬਾਈਨ ਕਹਿ ਰਿਹਾ ਵੀ ਕੰਬਾਈਨ ਲੈਣੀ ਆ ਹੁਣ ਆਪਾਂ ਨੇ ਹਾਂ ਨਾਭੇ ਨੇ ਜੀ ਪ੍ਰੀਤ ਵਾਲੇ ਹੈਗੇ ਨੇ ਅਤੇ ਗੱਲ ਕਰਕੇ ਆਇਆ ਸੀ ਜੀ ਆਪਾਂ ਉਹਨਾਂ ਤੋਂ ਕੰਬਾਈਨ ਲੈ ਲਾਂਗੇ ਹਾਂ ਕਹਿੰਦਾ ਸੀ ਨਾਲ ਤਾਂ ਆਪਾਂ ਆਪਣੇ ਕਰ ਲਿਆ ਕਰਾਂਗੇ ਅਤੇ ਨਾਲ ਹੀ ਆਪਾਂ ਕਰਾਏ 'ਤੇ ਦੇ ਦਿਆ ਕਰਾਂਗੇ ਚਾਰ ਪੈਸੇ ਆਪਣੇ ਹੋਰ ਆ ਜਿਆ ਕਰਨਗੇ ਹਾਂ ਇਹ ਇਹਦਾ ਤਾਂ ਦਿਮਾਗ ਹਾਂ ਦਿਮਾਗ ਰੌਸ਼ਨ ਕਰਤਾ ਜੀ ਉਹਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨੇ ਹਾਂ ਆਈਓ ਜੀ ਆਈਓ ਆਈਓ ਆਈਓ ਜੀ ਆਇਆ ਨੂੰ ਜੀ ਆਇਆ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ